ਬੈਂਕਿੰਗ ਅਤੇ ਬੀਮਾ ਸਾਡੇ ਭਵਿੱਖ ਲਈ ਸਾਨੂੰ ਕਾਫ਼ੀ ਸੇਵਾ ਦਿੰਦੇ ਰਹੇ ਹਾਂ ਜਿਸ ਨਾਲ ਅਸੀਂ ਆਪਣੇ ਭਵਿੱਖ ਲਈ ਕਾਫ਼ੀ ਯੋਜਨਾਵਾਂ ਬਣਾ ਸਕਦੇ ਹਾਂ ਜਿਵੇਂ ਕਿ ਪਹਿਲਾਂ ਅਮੀਰ ਲੋਕ ਹੀ ਬੀਮਾ ਕਰਵਾ ਸਕਦੇ ਸਨ ਪਰ ਹੁਣ ਬੈਂਕ ਅਤੇ ਬੀਮਾ ਕੰਪਨੀਆਂ ਨੇ ਬੀਮੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਹਨ ਹੁਣ ਗਰੀਬ ਲੋਕ ਵੀ ਬੀਮਾ ਕਰਵਾ ਸਕਦੇ ਹਨ ਹੁਣ ਬੈਂਕਾਂ ਵਿੱਚ ਸੁਰੱਖਿਆ ਜੀਵਨ ਬੀਮਾ ਜਿਸ ਦੇ ਵਿੱਚ ਸਾਲ ਦੇ ਅਤੇ ਬੈਂਕ ਵਿੱਚ ਕੱਟੇ ਜਾਂਦੇ ਹਨ ਅਤੇ ਦੁਰਘਟਨਾ ਹੋਣ ਕਰਕੇ ਮੌਤ ਹੋਣ 'ਤੇ ਦੋ ਲੱਖ ਰੁਪਏ ਮਿਲਦੇ ਹਨ ਇੱਕ ਜੀਵਨ ਬੀਮਾ ਜੋਤੀ ਬੀਮਾ ਹੈ ਜਿਸ ਵਿੱਚ ਤਿੰਨ ਸੌ ਪੈਂਤੀ ਰੁਪਏ ਸਾਲ ਦੇ ਕੱਟਦੇ ਹਨ ਪਰ ਮੌਤ ਹੋਣ 'ਤੇ ਦੋ ਲੱਖ ਰੁਪਏ ਮਿਲਦਾ ਹੈ ਹੁਣ ਸਭ ਗਰੀਬ ਵੀ ਇਹਨਾਂ ਦਾ ਲਾਹਾ ਲੈ ਸਕਦੇ ਹਨ